ਤਿੰਨ ਜਨਵਰੀ ਵੀਹ ਗਿਆਰਾਂ ਚਾਰ ਨਵੰਬਰ ਵੀਹ ਪੰਦਰਾਂ ਪੰਦਰਾਂ ਅਪ੍ਰੈਲ ਵੀਹ ਇੱਕੀ ਤੇਈ ਮਈ ਵੀਹ ਬਾਈ ਸਤਾਈ ਜੂਨ ਵੀਹ ਤੇਈ